ਖੇਡਾਂ ਖੇਡਣ ਨਾਲ਼ ਆਪਾਂ ਨੂੰ ਬਹੁਤ ਲਾਭ ਹੁੰਦੇ ਹਨ ਜਿਵੇਂ ਸਭ ਤੋਂ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਬੜਾ ਲਾਭ ਹੈਗਾ ਬੱਚਾ ਨਸ਼ੇ ਤੋਂ ਦੂਰ ਰਹਿੰਦਾ ਹੈ ਨਸ਼ੇ ਤੋਂ ਬਚਿਆ ਰਹਿੰਦਾ ਹੈ ਅਤੇ ਦੂਜਾ ਲਾਭ ਇਹ ਇਸਦਾ ਇਹ ਹੈ ਵੀ ਸਭ ਤੋਂ ਵਧੀਆ ਆਪਣਾ ਸਰੀਰ ਖੇਡਾਂ ਨਾਲ਼ ਵਧੀਆ ਮਜ਼ਬੂਤ ਬਣਦਾ ਹੈ ਬੰਦੇ ਦੀ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਤਾਕਤਵਰ ਹੁੰਦਾ ਹੈ ਖੇਡਾਂ ਖੇਡਣ ਨਾਲ ਨਾ ਬੱਚੇ ਦੀ ਸੋਚ ਦਾ ਘੇਰਾ ਵੀ ਵੱਧਦਾ ਹੈ ਜਿਵੇਂ ਬੱਚਾ ਅੱਜ ਗਰਾਊਂਡ 'ਚ ਖੇਲ ਕੇ ਜਾਂਦਾ ਹੈ ਜਾ ਕੇ ਰੋਟੀ ਪਾਣੀ ਖਾ ਕੇ ਫਰੈਸ਼ ਹੁੰਦਾ ਉਸ ਤੋਂ ਬਾਅਦ ਉਸਨੂੰ ਜਦੋਂ ਆਪਣਾ ਸਕੂਲ ਦਾ ਕੰਮ ਕਰੇਗਾ ਜਾਂ ਕੋਲਜ ਦਾ ਕੰਮ ਕਰੇਗਾ ਉਸਦਾ ਦਿਮਾਗ਼ ਦਾ ਘੇਰਾ ਸੋਚ ਦਾ ਘੇਰਾ ਵਧੇਗਾ ਖੇਡਾਂ ਖੇਡਣ ਨਾਲ ਤਾਂ ਹੀ ਤਾਂ ਕਹਿੰਦੇ ਨੇ ਵੀ ਸਰੀਰਕ ਅਤੇ ਮਾਸ ਮਾਨਸਿਕ ਤੌਰ 'ਤੇ ਦੋਨਾਂ ਚੀਜ਼ਾਂ ਦਾ ਵਿਕਾਸ ਹੁੰਦਾ ਹੈ ਖੇਡਾਂ ਖੇਡਣ ਬੰਦੇ ਨੇ ਇਨਸਾਨ ਲਈ ਬਹੁਤ ਜ਼ਰੂਰੀ ਹਨ ਜਿਹੜੇ ਬੰਦੇ ਖੇਡਾਂ ਨਹੀਂ ਖੇਡਦੇ ਉਹ ਸਰੀਰ ਪੱਖੋਂ ਕਮਜ਼ੋਰ ਹੁੰਦੇ ਹਨ ਭਲੇ ਉਹਨਾਂ ਦੇ ਸਰੀਰ ਤਕੜੇ ਬਣੇ ਹੁੰਦੇ ਹਨ ਪਰ ਸਰੀਰ ਪੱਖੋਂ ਕਮਜ਼ੋਰ ਹੁੰਦੇ ਹਨ ਕਿਉਂ ਉਹਨਾਂ ਦੇ ਚਰਬੀ ਚੜ੍ਹੀ ਹੁੰਦੀ ਹੈ ਫੈਟ ਬਹੁਤ ਚੜ੍ਹਿਆ ਹੁੰਦਾ ਉਹ ਬਹੁਤ ਜ਼ਿਆਦਾ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਖੇਡਾਂ ਮਨੁੱਖੀ ਸਰੀਰ ਲਈ ਖੇਡਣੀਆਂ ਬਹੁਤ ਜ਼ਰੂਰੀ ਹਨ